ਮੈਂ ਆਪਣੇ ਪਰਿਵਾਰ ਨਾਲ ਪਿਕਨਿਕ 'ਤੇ ਗੁਰਦੁਆਰਾ ਸਾਹਿਬ ਗਏ ਸੀਗੇ ਅਤੇ ਉੱਥੇ ਅਸੀਂ ਮਤਲਬ ਇਤਿਹਾਸਿਕ ਗੁਰਦੁਆਰਾ ਦੇਖਿਆ ਇਤਿਹਾਸਿਕ ਇਮਾਰਤਾਂ ਦੇਖੀਆਂ ਅਤੇ ਮੈਂ ਆਪਣੇ ਖਾਲੀ ਸਮੇਂ ਦੇ ਵਿੱਚ ਆਪਣੇ ਖਾਲੀ ਸਮੇਂ ਦੇ ਵਿੱਚ ਆਨੰਦ ਲੈਣ ਦੇ ਲਈ ਆਮ ਤੌਰ 'ਤੇ ਮੈਂ ਜ਼ਿਆਦਾਤਰ ਮਿਊਜ਼ਿਕ ਸੁਣਦੀ ਆਂਗੀ ਇਕੱਲਾ ਰਹਿਣਾ ਪਸੰਦ ਕਰਦੀ ਹਾਂ ਕਿਉਂਕਿ ਜਦੋਂ ਆਪਾਂ ਇਕੱਲੇ ਰਹਿੰਦੇ ਹਾਂ ਤਾਂ ਨੇਚਰ ਨਾਲ ਜੁੜਦੇ ਆਂਗੇ ਤਾਂ ਇਸੇ ਲਈ ਮੈਂ ਆਪਣੇ ਖਾਲੀ ਸਮੇਂ ਦੇ ਵਿੱਚ ਜਿਹੜਾ ਮਤਲਬ ਗੀਤ ਸੰਗੀਤ ਸੁਣਨਾ ਪਸੰਦ ਕਰਦੀ ਹਾਂ